ਹੈਲੋ ਰਵਿੰਦਰ ਬੋਲਦੇ ਹੋ ਜੀ ਮੈਂ ਤੁਹਾਡੀ ਕੰਪਲੇਂਟ ਕਰਨੀ ਸੀਗੀ ਵੀ ਤੁਸੀਂ ਮੈਂ ਤੁਹਾਡੇ ਤੋਂ ਕੱਲ੍ਹ ਕੈਬ ਬੁੱਕ ਕਰਵਾਈ ਸੀ ਅਤੇ ਤੁਸੀਂ ਬਹੁਤ ਗੰਦੇ ਤਰੀਕੇ ਨਾਲ ਕੈਬ ਚਲਾਈ ਸੀ ਪਹਿਲੇ ਤਾਂ ਮੈਂ ਤੁਹਾਡੇ ਕੰਪਲੇਂਟ ਕਰਨ ਲੱਗੀ ਸੀ ਓਫਿਸ਼ਅਲ ਸਾਈਟ 'ਤੇ ਫਿਰ ਮੈਂ ਸੋਚਿਆ ਚਲ ਮੈਂ ਗੱਲ ਕਰ ਲਵਾਂ ਵੀ ਤੁਸੀਂ ਬਹੁਤ ਤੇਜ਼ ਚਲਾਈ ਓਵਰਟੇਕ ਕੀਤਾ ਮੈਂ ਉਤੋਂ ਕੇਕ ਲੈ ਕੇ ਬੈਠੀ ਸੀ ਕਾਰ 'ਚ ਅਤੇ ਉਹ ਕੇਕ ਵੀ ਮੇਰੇ ਸਾਰਾ ਖ਼ਰਾਬ ਹੋ ਗਿਆ ਨਾਲੇ ਮੇਰੇ ਪੈਸੇ ਵੇਸਟ ਹੋ ਗਏ ਅਤੇ ਮੇਰਾ ਸਾਰੀ ਪਾਰਟੀ ਖ਼ਰਾਬ ਹੋ ਗਈ ਨਹੀਂ ਜੀ ਤੁਸੀਂ ਕੱਲ੍ਹ ਬਹੁਤ ਮਤਲਬ ਬਹੁਤ ਤੇਜ਼ ਚਲਾਈ ਨਾਲੇ ਦੋ ਤਿੰਨ ਵਾਰ ਤਾਂ ਐਕਸੀਡੈਂਟ ਹੋਣ ਦਾ ਹੀ ਡਰ ਰਿਹਾ ਸੀ ਨਾਲੇ ਤੁਸੀਂ ਨਾ ਹੀ ਰਸਤਾ ਤੁਸੀਂ ਵਧੀਆ ਚੂਜ ਕੀਤਾ ਖੱਡੇ ਵਾਲੇ ਰਸਤਾ ਚੂਜ ਕਰ ਲਿਆ ਜਿਹਦੇ ਕਰਕੇ ਸਾਰਾ ਵੇਸਟ ਹੋ ਗਿਆ ਮੇਰਾ ਕੇਕ ਨਹੀਂ ਜੀ ਤੁਸੀਂ ਕੀਤਾ ਸੀਗਾ ਮੈਂ ਤੁਹਾਨੂੰ ਕਿਹਾ ਵੀ ਸੀਗਾ ਵੀ ਹੌਲੀ ਚਲਾ ਲਓ ਪਰ ਤੁਸੀਂ ਮੰਨੇ ਹੀ ਨਹੀਂ ਨਾ ਹੀ ਤੁਸੀਂ ਗੂਗਲ ਪੇ ਚਲਾਇਆ

ਉਹ ਹੀ ਤਾਂ ਤੁਸੀਂ ਰਾਸਤਾ ਹੀ ਨਹੀਂ ਵਧੀਆ ਚੁਣਿਆ ਤਾਂ ਕਰਕੇ ਕਹੀ ਜਾਨੀ ਹਾਂ ਹੈਲੋ ਪਹਿਲਾਂ ਤਾਂ ਮੈਂ ਤੁਹਾਡੀ ਕੰਪਲੇਂਟ ਕਰਨ ਹੀ ਲੱਗੀ ਸੀ ਫਿਰ ਮੈਂ ਕਿਹਾ ਚੱਲ ਗੱਲ ਕਰ ਲਵਾਂ ਪਰ ਹੁਣ ਤੁਸੀਂ ਮੰਨਦੇ ਕੀ ਪਏ ਹੈਗੇ ਇਹ ਤਾਂ ਚਲ ਵੈਸੇ ਮੈਂ ਕਿਹਾ ਚਲ ਤੁਹਾਡੇ ਨਾਲ ਗੱਲ ਕਰ ਲੈਂਦੀ ਹਾਂ ਜੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਕਰ ਵੀ ਦਿੰਦਾ ਨਾ ਹੀ ਤੁਸੀਂ ਨਾ ਹੀ ਤੁਸੀਂ ਗੂਗਲ ਪੇ ਚਲਾ ਰੱਖਿਆ ਕਿਉਂਕੀ ਮੇਰੇ ਕੋਲ ਕੈਸ਼ ਹੈ ਘੱਟ ਸੀਗਾ ਫਿਰ ਵੀ ਮੈਂ ਮੈਨੇਜ ਕਰਕੇ ਤੁਹਾਨੂੰ ਦਿੱਤਾ ਮੇਰੇ ਕੋਲ ਕੈਸ਼ ਜੇ ਨਾ ਹੁੰਦਾ ਤਾਂ ਮੈਂ ਤੈਨੂੰ ਕਿਵੇਂ ਪੇਮੈਂਟ ਕਰਦੀ ਨਾ ਹੀ ਤੁਸੀਂ ਗੂਗਲ ਪੇ ਚਲਾਉਂਦੇ ਹਾਂਜੀ ਪਲੀਜ ਅੱਗੇ ਤੋਂ ਧਿਆਨ ਰੱਖਣਾ ਹਾਂ ਜੇ ਨਾ ਨਾ ਕੀਤਾ ਤਾਂ ਫਿਰ ਮੈਂ ਕੰਪਲੇਂਟ ਪੱਕਾ ਕਰੂੰਗੀ ਆਫਿਸ਼ਅਲ ਸਾਈਟ 'ਤੇ

ਓਕੇ ਠੀਕ ਠੀਕ ਹੈ ਨਹੀਂ ਹੋਣਾ ਚਾਹੀਦਾ ਅੱਗੇ ਤੋਂ